ਭਾਰਤ ਦੇ ਫੈਸ਼ਨ ਵਿੱਚ ਹੁਣ ਬਹੁਤ ਜ਼ਿਆਦਾ ਬਦਲਾਅ ਹੋ ਚੁੱਕਾ ਹੈ ਜਿਵੇਂ ਕਿ ਪਹਿਲਾਂ ਲੋਕ ਟਰੈਡੀਸ਼ਨਲ ਪਾਉਂਦੇ ਸੀ ਕੁੜਤੇ ਪਜਾਮੇ ਸਲਵਾਰ ਸੂਟ ਪਰ ਹੁਣ ਦੇਖਿਆ ਜਾਵੇ ਲੋਕ ਟਰੈਡੀਸ਼ਨਲ ਘੱਟ ਹੀ ਪਾਉਂਦੇ ਨੇ ਅਤੇ ਜ਼ਿਆਦਾ ਕਰਕੇ ਜੀਨ ਟੋਪ ਹੋ ਗਏ ਪੈਂਟ ਕਮੀਜ਼ ਹੋ ਗਏ ਐਵੇਂ ਦੇ ਪਾਉਂਦੇ ਨੇ ਅਤੇ ਪਹਿਲੇ ਦੇਖਿਆ ਜਾਵੇ ਤਾਂ ਆਪਾਂ ਭਾਰਤ ਵਿੱਚ ਜਿਹੜਾ ਕੱਪੜਾ ਉਹ ਸਸਤਾ ਮਿਲਦਾ ਸੀ ਅਤੇ ਹੁਣ ਲੋਕਾਂ ਨੇ ਬ੍ਰਾਂਡ ਦੇ ਨਾਮ 'ਤੇ ਲੋਕਾਂ ਨੂੰ ਪਾਗਲ ਬਣਾਉਣਾ ਸਟਾਰਟ ਕਰ ਦਿੱਤਾ ਜਿਵੇਂ ਕਿ ਹੁਣ ਹਜ਼ਾਰਾਂ ਹੀ ਲੋਕ ਬ੍ਰੈਂਡ ਦੇ ਇੱਕ ਨਾਮ ਪਿੱਛੇ ਲਗਾ ਦਿੰਦੇ ਹੁਣ ਪੱਛਮੀ ਭਾਰਤ ਨੇ ਪੱਛਮੀ ਭਾਰਤ ਦਾ ਜਿਹੜਾ ਫੈਸ਼ਨ ਹੈ ਉਹ ਭਾਰਤ ਵਿੱਚ ਬਹੁਤ ਜ਼ਿਆਦਾ ਸ਼ੁਰੂ ਹੋ ਚੁੱਕਿਆ ਅਤੇ ਰੋਜ਼ ਟਰੈਂਡ ਵੀ ਚੇਂਜ ਹੁੰਦੇ ਰਹਿੰਦਾ ਨੇ ਜਿਵੇਂ ਕਿ ਕਦੇ ਪੈਂਟ ਕਮੀਜ਼ ਆ ਨੀ ਕਦੇ ਕੁੜਤੇ ਪਜਾਮੇ ਦਾ ਆ ਜਾਂਦਾ ਹੈ ਜੀਨ ਟੋਪ ਦੀ ਜਗ੍ਹਾ ਵੀ ਬਹੁਤ ਜ਼ਿਆਦਾ ਕਦੇ ਲੋਕ ਹੋਰ ਕੁਛ ਪਾ ਲੈਂਦੇ ਹੈ ਕਦੇ ਬੋਲਦੇ ਵੀ ਆਹ ਟਰੈਂਡ ਆ ਗਿਆ ਅਤੇ ਮੈਂ ਤਾਂ ਵੈਸੇ ਜ਼ਿਆਦਾ ਕਰਕੇ ਜੇ ਪਹਿਨਣ ਵਿੱਚ ਪਸੰਦ ਹੋਵੇ ਤਾਂ ਮੈਂ ਸੂਟ ਸਲਵਾਰ ਹੀ ਪੈਮ ਪਾਵਾਂਗੀ ਕਿਉਂਕਿ ਇੱਕ ਤਾਂ ਇਹ ਆਪਣੇ ਪੰਜਾਬ ਦੀ ਡਰੈੱਸ ਹੈ ਅਤੇ ਦੂਜਾ ਇਹਨੂੰ ਅਸੀਂ ਜਿਹੜਾ ਖਰੀਦਦੇ ਆਪਾਂ ਨਵਾਂਸ਼ਹਿਰ ਤੋਂ ਹੀ ਖਰੀਦਦੇ ਆ ਆਪਣੀ ਮੀਨਿੰਗ ਕਿ ਸਾਡੀ ਖੁਦ ਦੀ ਸ਼ੋਪ ਹੈ ਅਤੇ ਉੱਥੋਂ ਮੈਨੂੰ ਵਧੀਆ ਵੀ ਲੱਗਦੇ ਹੈ ਕੱਪੜੇ ਖਰੀਦਣਾ ਅਤੇ ਜ਼ਿਆਦਾ ਕਰਕੇ ਮੈਂ ਜਿਹੜਾ ਸੂਟ ਸਲਵਾਰ ਹੀ ਪਾਉਣਾ ਪਸੰਦ ਕਰਦੀ ਹਾਂ